ਵੀਹ ਫਰਵਰੀ ਉੱਨੀ ਅੱਸੀ ਤੇਈ ਮਈ ਉੱਨੀ ਅਠਾਸੀ ਪੱਚੀ ਜੂਨ ਵੀਹ ਇੱਕੀ ਦਸ ਅਗਸਤ ਵੀਹ ਬਾਈ ਤੀਹ ਅਕਤੂਬਰ ਵੀਹ ਚੌਵੀ